ਮੌਨਸੂਨ ਸੀਜਨ ਨੇ ਸਾਡੇ ਪੰਜਾਬ ਦੇ ਖੇਤਰ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਜਿਵੇਂ ਪਹਿਲਾਂ ਪਹਿਲਾਂ ਵਾਲੇ ਟਾਇਮਾਂ ਨਾਲੋਂ ਅੱਜ ਦੇ ਟਾਈਮ 'ਚ ਜ਼ਿਆਦਾ ਵਰਖਾ ਆਉਂਦੀ ਹੈ ਅਤੇ ਐਹੀ ਵਰਖਾ ਆਉਂਦੀ ਹੈ ਕਈ ਵਾਰ ਤਾਂ ਹੜ੍ਹ ਵੀ ਆ ਜਾਂਦੇ ਆ ਪਿੱਛੇ ਜੇ ਮੈਂ ਫਤਿਹਗੜ੍ਹ ਸਾਹਿਬ ਵਾਲਾ ਰਹਿਣ ਵਾਲਾ ਹੈ ਅਤੇ ਇੱਥੇ ਹੜ੍ਹ ਆ ਕੇ ਹਟੇ ਉਹਨੇ ਸਾਡੇ ਜੀਵਨ ਨੂੰ ਅਤੇ ਨਾਲ ਦੇ ਏਰੀਏ ਨੂੰ ਬਹੁਤ ਪ੍ਰਭਾਵਿਤ ਕੀਤਾ ਜਿਵੇਂ ਮੈਂ ਖੇਤੀ ਖੇਤੀਬਾੜੀ ਕਰਨ ਵਾਲਾ ਬੰਦਾ ਹਾਂ ਅਤੇ ਖੇਤੀ ਹਾਲੇ ਝੋਨਾ ਲਾਇਆ ਹੀ ਸੀਗਾ ਅਤੇ ਉਹ ਜਮਾਂ ਹੀ ਬ ਪਾਣੀ ਨੇ ਜ਼ਿਆਦਾ ਪਾਣੀ ਹੋਣ ਕਰਕੇ ਉਹ ਸਾਰੇ ਹੀ ਬਰਬਾਦ ਹੋ ਗਿਆ ਅਤੇ ਇਹਨਾਂ ਨੇ ਸਾਡੇ ਜੀਵਨ ਨੂੰ ਬਹੁਤ ਪ੍ਰਭਾਵਿਤ ਕੀਤਾ